ਪੌਦਿਆਂ ਦੇ ਹੋਣ ਨਾਲ ਸਾਡਾ ਵਾਤਾਵਰਣ ਸਾਫ ਰਹਿੰਦਾ ਹੈ ਅਤੇ ਦਿਲ ਵੀ ਖਿੜਿਆ ਰਹਿੰਦਾ ਹੈ ਪੌਦੇ ਸਾਡੇ ਆਸ ਪਾਸ ਦੀ ਹਵਾ ਨੂੰ ਸਾਫ ਕਰਦੇ ਹਨ ਪੌਦਿਆਂ ਦਾ ਬਚਨਾ ਜ਼ਿਆਦਾ ਗਰਮੀ ਜਾਂ ਸਰਦੀ ਦੇ ਵਿੱਚ ਮੁਸ਼ਕਿਲ ਹੁੰਦਾ ਹੈ ਕੁਝ ਪੌਦੇ ਘਰ ਘਰ ਵਿੱਚ ਪਾਏ ਜਾਂਦੇ ਹਨ ਪਰੰਤੂ ਕੁਝ ਪੌਦੇ ਜਿਵੇਂ ਕਿ ਡਰੈਗਨ ਫਰੂਟ ਕਿਤੇ ਕਿਤੇ ਹੀ ਉਗਾਏ ਜਾਂਦੇ ਹਨ ਅਤੇ ਉਨਾਂ ਨੂੰ ਖਾਸ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ ਪੌਦਿਆਂ ਨੂੰ ਗਰਮੀ ਦੇ ਵਿੱਚ ਦਿਨ ਵਿੱਚ ਘੱਟੋ ਘੱਟ ਦੋ ਵਾਰ ਚੰਗੀ ਤਰ੍ਹਾਂ ਪਾਣੀ ਲਗਾਉਣਾ ਪੈਂਦਾ ਹੈ ਤਾਂ ਜੋ ਉਹ ਚੰਗੀ ਤਰ੍ਹਾਂ ਖਿੜੇ ਰਹਿਣ ਅਤੇ ਵਾਸ਼ਪੀਕਰਨ ਦੇ ਕਾਰਨ ਉਹ ਮੁਰਝਾ ਨਾ ਜਾਣ ਇਸੇ ਤਰ੍ਹਾਂ ਵਾਧੂ ਸਰਦੀ ਦੇ ਵਿੱਚ ਵੀ ਪੌਦਿਆਂ ਨੂੰ ਚੰਗੀ ਦੇਖਭਾਲ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਸਮੇਂ ਸਿਰ ਪਾਣੀ ਅਤੇ ਖਾਦ ਪਾਉਣੀ ਪੈਂਦੀ ਹੈ ਤਾਂ ਜੋ ਉਹ ਚੰਗੀ ਤਰ੍ਹਾਂ ਵੱਧਣ ਫੁੱਲਣ